ਮੈਂ ਉਸ ਵਿਅਕਤੀ ਨੂੰ ਇਹ ਸਲਾਹ ਦੇਵਾਂਗੀ ਜੋ ਪਹਿਲੀ ਵਾਰ ਭੰਗੜਾ ਐਰੋਬਿਕਸ ਕਰਨ ਵਿੱਚ ਦਿਲਚਸਪੀ ਰੱਖਦਾ ਹੋਵੇ ਕਿ ਤੁਸੀਂ ਭੰਗੜੇ ਨੂੰ ਇੱਕ ਐਕਸਰਸਾਈਜ਼ ਸਮਝ ਕੇ ਕਰੋ ਇਹ ਇੱਕ ਐਕਸਰਸਾਈਜ਼ ਹੈ ਜੋ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਕਰ ਸਕਦੇ ਹਨ ਭੰਗੜਾ ਸਿੱਖਣ ਵਾਸਤੇ ਵੀ ਬਹੁਤ ਅਕੈਡਮੀਆਂ ਖੁੱਲ੍ਹੀਆਂ ਹੋਈਆਂ ਹਨ ਤੁਸੀਂ ਉੱਥੇ ਜਾ ਕੇ ਵੀ ਸਿੱਖ ਸਕਦੇ ਹੋ ਜੇਕਰ ਤੁਹਾਨੂੰ ਨਹੀਂ ਪਤਾ ਹੋਵੇ ਇੱਕ ਦੂਸਰੇ ਤੋਂ ਆਪਣੇ ਆਸ ਪਾਸ ਤੋਂ ਵਾਲਿਆਂ ਤੋਂ ਵੀ ਪਤਾ ਕਰ ਸਕਦੇ ਹੋ ਸਾ ਮੇਰੇ ਆਪਣੇ ਜਾਣਕਾਰਾਂ ਵਿੱਚ ਕਈ ਅਕੈਡਮੀਆਂ ਭੰਗੜਾ ਸਿਖਾਉਣ ਵਾਲੀਆਂ ਅਕੈਡਮੀਆਂ ਹਨ ਮੈਂ ਉਹਨਾਂ ਨੂੰ ਉਥੋਂ ਦਾ ਨੰਬਰ ਵੀ ਦੇ ਸਕਦੀ ਹਾਂ ਅਤੇ ਤੁਹਾਨੂੰ ਓਹਨਾਂ ਨਾਲ ਮਿਲਾ ਸਕਦੀ ਹਾਂ ਉਹ ਉਹਨਾਂ ਨੇ ਕਈ ਵੱਡੇ ਨੂੰ ਟ੍ਰੇਨਿੰਗ ਦਿੱਤੀ ਹੈ ਅਤੇ ਉਹ ਅੱਛਾ ਪ੍ਰਦਰਸ਼ਨ ਕਰ ਰਹੇ ਹਨ ਭੰਗੜਾ ਇੱਕ ਸਿਰਫ ਇੱਕ ਹੈ ਹੀ ਇੱਕ ਯੋਗਾ ਜਾਂ ਐਕਸਰਸਾਈਜ਼ ਹੀ ਨਹੀਂ ਸਾਡੇ ਪੰਜਾਬ ਦਾ ਪੂਰਾ ਮੇਨ ਡਾ ਭੰਗ ਹੈ ਇਹਨੂੰ ਕਿਸੇ ਵੀ ਫੰਕਸ਼ਨ ਵਿੱਚ ਕਿਸੇ ਵੀ ਤਰ੍ਹਾਂ ਦੇ ਵਿੱਚ ਸਕੂਲ ਵਿਚ ਸਿੱਖ ਸ ਪੇਸ਼ ਕੀਤਾ ਜਾ ਸਕਦਾ ਹੈ ਸਟੇਜ 'ਤੇ ਵੀ ਇਸਨੂੰ ਪੇਸ਼ ਕਰਕੇ ਕਈ ਬੱਚੇ ਬਹੁਤ ਵੱਡੇ ਵੱਡੇ ਇਨਾਮ ਹਾਸਿਲ ਕਰਦੇ ਹਨ ਭੰਗੜਾ ਇੱਕ ਐਸੀ ਚੀਜ਼ ਹੈ ਜੋ ਜਿਸ ਵਿੱਚ ਕੋਈ ਵੀ ਕਰ ਸਕਦਾ ਹੈ ਬੁੱਢਾ ਜੋ ਵ ਜਵਾਨ ਵੱਡਾ ਕੋਈ ਲੜਕੀ ਜਾਂ ਲੜਕਾ ਕੋਈ ਵੀ ਕਰ ਸਕਦਾ ਹੈ